ਜੀ ਮੈਂ ਆਪਣੇ ਭਵਿੱਖ ਵਿੱਚ ਗਾਉਣ ਬਾਰੇ ਵੱਖ ਵੱਖ ਗੋਲ ਸੋਚੇ ਹੋਏ ਹਨ ਸਭ ਤੋਂ ਪਹਿਲਾ ਗੋਲ ਮੇਰਾ ਇਹ ਹੈ ਕਿ ਮੈਂ ਸਿੰਗਰ ਪਲੇਬੈੱਕ ਸਿੰਗਰ ਬਣਨਾ ਚਾਹੁੰਦਾ ਹਾਂ ਉਸ ਤੋਂ ਇਲਾਵਾ ਮੈਂ ਸਾਊਂਡ ਸਾਊਂਡ ਇੰਜਰੀਅਰਿੰਗ ਦਾ ਕੋਰਸ ਕੀਤਾ ਹੋਇਆ ਹੈ ਗਾਉਣ ਦੇ ਨਾਲ ਨਾਲ ਪੇਬੈੱਕ ਸਿੰਗਿੰਗ ਦੇ ਨਾਲ ਨਾਲ ਮੈਂ ਸਾਊਂਡ ਇੰਜਰੀਅਰਿੰਗ ਵੀ ਕਰਨਾ ਚਾਹੁੰਦਾ ਔਰ ਮੈਂ ਬਚਪਨ ਤੋਂ ਹੀ ਮਿਊਜ਼ਿਕ ਨਾਲ ਜੁੜਿਆ ਹੋਇਆ ਹਾਂ ਔਰ ਮੈਂ ਮੇਰੇ ਭਵਿੱਖ ਵਿੱਚ ਗਾਉਣ ਸਬੰਧੀ ਜਾਂ ਤਾਂ ਟੀਚਿੰਗ ਦੀ ਲਾਈਨ ਵੀ ਚੂਜ ਕਰ ਸਕਦਾ ਹਾਂ ਜਾਂ ਪਲੇਬੈੱਕ ਸਿੰਗਿੰਗ ਵੀ ਚੂਜ਼ ਕਰ ਸਕਦਾ ਹਾਂ ਇਸ ਦੇ ਨਾਲ ਨਾਲ ਸਾਊਡ ਇੰਜਰੀਅਰਿੰਗ ਯਾਨੀ ਕਿ ਮਿਊਜ਼ਿਕ ਡਾਇਰੈਕਸ਼ਨ ਵੀ ਚੂਜ਼ ਕਰੂੰਗਾ